ਹਾਂਜੀ ਅਸੀਂ ਥੋਕ ਬਾਜ਼ਾਰ ਵਿੱਚੋਂ ਹੀ ਸਮਾਨ ਖਰੀਦਦੇ ਹਾਂ ਇਹ ਅੰਮ੍ਰਿਤਸਰ ਵਿੱਚ ਅਤੇ ਤਰਨ ਤਾਰਨ ਵਿੱਚ ਹਨ ਜਿਵੇਂ ਆਟਾ ਮੰਡੀ ਘਿਓ ਮੰਡੀ ਅਤੇ ਹੋਰ ਬਹੁਤ ਸਾਰੀਆਂ ਮੰਡੀਆਂ ਹਨ ਜਿੱਥੋਂ ਅਸੀਂ ਥੋਕ ਦਾ ਸਮਾਨ ਖਰੀਦਦੇ ਹਾਂ ਅਸੀਂ ਇਥੋਂ ਮਹੀਨੇ ਦਾ ਇਕੱਠਾ ਰਾਸ਼ਨ ਚੁੱਕਦੇ ਹਾਂ ਪਰ ਕੁਝ ਸਾਲਾਂ ਤੋਂ ਕਰਿਆਨੇ ਅਤੇ ਸਬਜ਼ੀਆਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ ਕਿਉਂਕਿ ਜਾਂ ਤਾਂ ਇਹ ਕੁਦਰਤੀ ਮੌਸਮੀ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ ਜਾਂ ਫਸਲਾਂ ਦਾ ਝਾੜ ਘੱਟ ਹੁੰਦਾ ਹੈ ਇਸ ਲਈ ਮੰਡੀਆਂ ਚੋਂ ਦੁਕਾਨਾਂ ਤੱਕ ਅਤੇ ਦੁਕਾਨਾਂ ਤੋਂ ਦੁਕਾਨਾਂ ਤੋਂ ਛੋਟੀਆਂ ਦੁਕਾਨਾਂ ਤੱਕ ਸਮਾਨ ਆਉਂਦਿਆਂ ਬਹੁਤ ਮਹਿੰਗਾ ਹੋ ਜਾਂਦਾ ਹੈ ਕਿਉਂਕਿ ਹਰ ਕੋਈ ਆਪਣਾ ਮੁਨਾਫ਼ਾ ਕੱਢਦਾ ਹੈ ਇਸ ਲਈ ਅਸੀਂ ਕਦੀ ਸੋਚਦੇ ਹਾਂ ਕਿ ਅਸੀਂ ਔਨਲਾਈਨ ਖਰੀਦਦਾਰੀ ਕੀ ਕਰੀਏ ਇਸ ਲਈ ਅਸੀਂ ਔਨਲਾਈਨ ਖਰੀਦਦਾਰੀ ਕਰਦੇ ਵੀ ਹਾਂ ਅਤੇ ਕਈ ਵਾਰ ਸਾਨੂੰ ਔਨਲਾਈਨ ਖਰੀਦਦਾਰੀ 'ਚ ਕੁਝ ਸਮਾਨ ਮਾੜਾ ਪੈਂਦਾ ਹੈ ਅਤੇ ਕੁਝ ਚੰਗੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਕਿਉਂਕਿ ਅਸੀਂ ਖੁਦ ਦੁਕਾਨ 'ਤੇ ਜਾ ਕੇ ਜਿਹੜੀ ਖਰੀਦਦਾਰੀ ਕਰਦੇ ਹਾਂ ਉਹਦੇ ਵਿੱਚ ਅਸੀਂ ਚੰਗੀਆਂ ਚੀਜ਼ਾਂ ਵੀ ਫੜ ਕੇ ਦੇਖ ਸਕਦੇ ਹਾਂ ਅਤੇ ਮਾੜੀਆਂ ਵੀ ਇਸ ਲਈ ਸਾਨੂੰ ਕੁਝ ਚੀਜ਼ਾਂ ਔਨਲਾਈਨ ਮਾੜੀਆਂ ਪੈਂਦੀਆਂ ਨੇ ਅਤੇ ਕੁਝ ਚੰਗੀਆਂ ਧੰਨਵਾਦ